ਬਾਰਾਂ ਮਾਰਚ ਉੱਨੀ ਸੌ ਉਨਾਸੀ ਤੇਰ੍ਹਾਂ ਜੁਲਾਈ ਉੱਨੀ ਸੌ ਉਨਾਸੀ ਤੇਰ੍ਹਾਂ ਸਤੰਬਰ ਦੋ ਹਜ਼ਾਰ ਪੰਜ ਇਕੱਤੀ ਜਨਵਰੀ ਦੋ ਹਜ਼ਾਰ ਸੱਤ ਅਤੇ ਇੱਕ ਅਪ੍ਰੈਲ ਦੋ ਹਜ਼ਾਰ ਅੱਠ